ਹਾਂਜੀ ਮੈਂ ਗੱਲ ਕਰਨ ਜਾ ਰਿਹਾ ਮੋਹਾਲੀ ਜ਼ਿਲ੍ਹੇ ਵਿੱਚ ਆਵਾਜਾਈ ਦੇ ਮੁੱਖ ਸਾਧਨਾਂ ਦੀ ਜੇਕਰ ਮੋਹਾਲੀ ਜ਼ਿਲ੍ਹੇ ਵਿੱਚ ਸੜਕਾਂ ਸੜਕੀ ਸਾਧਨ ਦੇਖੇ ਜਾਣ ਤਾਂ ਮੋਹਾਲੀ ਜਿਲ੍ਹੇ ਵਿੱਚ ਬਹੁਤ ਹੀ ਵਧੀਆ ਸਾਧਨਾਂ ਉਪਲਬਧ ਹਨ ਜਿਵੇਂ ਕਿ ਬੱਸ ਬੱਸਾਂ ਕੈਬ ਆਦਿ ਸਾਰੇ ਸਾਧਨ ਸੜਕੀ ਆਵਾਜਾਈ ਨਾਲ ਸੰਬੰਧਿਤ ਉਪਲਬਧ ਹਨ ਅਤੇ ਇਹ ਕੁਛ ਖਾਸ ਮਹਿੰਗੇ ਵੀ ਨਹੀਂ ਸਸਤਾ ਸਸਤੀ ਹੀ ਪੈ ਜਾਂਦੇ ਹਨ ਕੈਬ ਵੀ ਅਤੇ ਬੱਸ ਨਾਲ ਸੰਬੰਧਿਤ ਵੀ ਅਤੇ ਜੇਕਰ ਆਪਾਂ ਮੋਹਾਲੀ ਜਿਲ੍ਹੇ ਵਿੱਚ ਰੇਲਵੇ ਦੀ ਗੱਲ ਕੀਤੀ ਜਾਵੇ ਤਾਂ ਰੇਲਵੇ ਵੀ ਬਹੁਤ ਹੀ ਸਸਤਾ ਅਤੇ ਟਿਕਾਊ ਸਾਧਨ ਹੈ ਮੋਹਾਲੀ ਜ਼ਿਲ੍ਹੇ ਵਿੱਚ ਅਤੇ ਮੋਹਾਲੀ ਜ਼ਿਲ੍ਹੇ ਵਿੱਚ ਇੱਕ ਹਵਾਈ ਅੱਡਾ ਵੀ ਹੈ ਜੋ ਕਿ ਮੋਹਾਲੀ ਦੇ ਵਿੱਚ ਹੀ ਹੈ ਇਹ ਵੀ ਮੋਹਾਲੀ ਅੱਡੇ ਦੀ ਵੀ ਇੱਕ ਆਪਣੀ ਅਹਿਮੀਅਤ ਹੈ ਅਤੇ ਇਹ ਇਸ ਤੋਂ ਬਾਹਰਲੀ ਬਾਹਰ ਵਿਦੇਸ਼ਾਂ ਲਈ ਵੀ ਬਹੁਤ ਸਾਰੀਆਂ ਜੋ ਕਿ ਫਲਾਈਟਾਂ ਜਾਂਦੀਆਂ ਹਨ ਹਰ ਹਰ ਰੋਜ਼ ਸੋ ਜੇਕਰ ਕੁੱਲ ਦੇਖਿਆ ਜਾਵੇ ਤਾਂ ਮੋਹਾਲੀ ਜ਼ਿਲ੍ਹੇ ਵਿੱਚ ਸੜਕੀ ਰੇਲਵੇ ਅਤੇ ਹਵਾਈ ਤਿੰਨੇ ਆਵਾਜਾਈ ਦੇ ਸਾਧਨਾਂ ਵਿੱਚ ਵਧੀਆ ਇੱਕ ਇਹਨਾਂ ਦੀ ਛਾਪ ਹੈ